ਅੱਜ ਦੇ ਦੌਰ ਵਿੱਚ ਖੇਤੀ ਨੂੰ ਪੁਰਤਾਏ ਉਤਸ਼ਾਹਿਤ ਕਰਨ ਲਈ ਉਹ ਅੱਡ ਅੱਡ ਤਰ੍ਹਾਂ ਦੇ ਖੋਜ ਪ੍ਰੋਗਰਾਮ ਵਿਕਸਿਤ ਕੀਤੇ ਗਏ ਨੇ ਇਹਦੀ ਇਹਦੀ ਇਹਦੇ ਵਿੱਚ ਸਰਕਾਰ ਦਾ ਅਤੇ ਜਾਂ ਸਥਾਨਿਕ ਜ ਜੋ ਵੀ ਕਹਿ ਦੇਈਏ ਖੇਤੀ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਉਹਨਾਂ ਦਾ ਬਹੁਤ ਯੋਗਦਾਨ ਹੈ ਸਰਕਾਰ ਨੇ ਅੱਜ ਕੱਲ੍ਹ ਕਿਸਾਨਾਂ ਦੇ ਫਾਇਦੇ ਲਈ ਵੱਧ ਤੋਂ ਵੱਧ ਯੋਜਨਾਵਾਂ ਚਲਾਈਆਂ ਹਨ ਤਾਂ ਕਿ ਉਹ ਉਹਨਾਂ ਦਾ ਨਿੱਜੀ ਫਾਇਦਾ ਲੈ ਸਕਣ ਜਾਂ ਸਥਾਨਕ ਤੌਰ 'ਤੇ ਵੀ ਉਹਨਾਂ ਦਾ ਫਾਇਦਾ ਤ ਚੱਕਿਆ ਜਾ ਸਕਦਾ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਕਿਸਾਨਾਂ ਨੂੰ ਆਹਾ ਜਿਹੜੇ ਉਦਯੋਗਿਕ ਪ੍ਰੋਗਰਾਮ ਹੁੰਦੇ ਹਨ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਕਹਿ ਦੇਈਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਦੇ ਸਦਾ ਸਹਾਰੇ ਉਹ ਆਪਣੇ ਪ੍ਰੋਗਰਾਮ ਨੂੰ ਵਿਕਸਿਤ ਕਰ ਸਕਣ ਨਹੀਂ ਤਾਂ ਕਈ ਵਾਰ ਕਿਸਾਨ ਦੇ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਉਹਦੇ ਕੋਲ ਇਹ ਤਾਂ ਹੁੰਦਾ ਕਿ ਮੈਂ ਇਹ ਕੰਮ ਕਰਾਂ ਪਰ ਉਹਦੇ ਕੋਲ ਉਹਨੂੰ ਲਾਉਣ ਲਈ ਪੈਸਾ ਨਹੀਂ ਹੁੰਦਾ ਜਾਂ ਕਹਿ ਦੇਈਏ ਕੋਈ ਸੇਧ ਨਹੀਂ ਹੁੰਦੀ ਜਦੋਂ ਆਪਾਂ ਨੂੰ ਸਰਕਾਰ ਦੇ ਸਹਾਰੇ ਕੋਈ ਪ੍ਰੋਗਰਾਮ ਦੇ ਸਹਾਰੇ ਉਹਦੀ ਸੇਧ ਮਿਲ ਜਾਂਦੀ ਹੈ ਤਾਂ ਉਸ ਕੰਮ ਨੂੰ ਅਸੀਂ ਚੰਗੀ ਤਰ੍ਹਾਂ ਵਿਕਸਿਤ ਕਰ ਸਕਦੇ ਹਾਂ ਜਾਂ ਅੱਗੇ ਵਧਾ ਸਕਦੇ ਹਨ ਕਿਉਂਕਿ ਖੇਤੀਬਾੜੀ ਦਾ ਤਾਂ ਕੰਮ ਇਹੋ ਜਿਹਾ ਹੁੰਦਾ ਹੈ ਕਿ ਇਹ ਤਾਂ ਹੈ ਨਹੀਂ ਕਿ ਉਹ ਅੱਜ ਦੇ ਦਿਨ ਲਾਇਆ ਅਤੇ ਕੱਲ੍ਹ ਦੇ ਦਿਨ ਆਪਾਂ ਨੂੰ ਉਹਦੇ ਤੋਂ ਆ ਕਹਿ ਦੇਈਏ ਆਪਾਂ ਨੂੰ ਆਮਦਨ ਆਉਣ ਲੱਗ ਗਈ ਇਹ ਤਾਂ ਇਹੋ ਜਿਹਾ ਕੰਮ ਹੁੰਦਾ ਕਿ ਸਾਨੂੰ ਛੇ ਛੇ ਮਹੀਨੇ ਇਹਦੇ ਵਾਸਤੇ ਰੁਕਣਾ ਪੈਂਦਾ ਛੇ ਮਹੀਨੇ ਬਾਅਦ ਸਾਨੂੰ ਇੱਕ ਆਮਦਨ ਦਾ ਸ ਕਹਿ ਦੇਈਏ ਰਾਹ ਮਿਲਦਾ ਇਸ ਕਰਕੇ ਸਰਕਾਰ ਨੇ ਇਹਨੂੰ ਜਾਤੋਂ ਤੋਂ ਜ਼ਿਆਦਾ ਵਿਸਥਾਰ ਪੂਰਵਕ ਕਰਨ ਵਾਸਤੇ ਅ ਜਿਹੜੇ ਲੋਕਾਂ ਨੂੰ ਇਹਦੀ ਮਦਦ ਦਿੱਤੀ ਹੈ ਜਿਵੇਂ ਸਰਕਾਰ ਨੇ ਅੱਡ ਅੱਡ ਯੋਜਨਾਵਾਂ ਬਣਾਈਆਂ ਹਨ ਖੇਤਰੀ ਬੈਂਕ ਹੈ ਜਿਹੜੇ ਕਿ ਇਹਨਾਂ ਯੋਜਨਾਵਾਂ ਨੂੰ ਯੋਜਨਾਵਾਂ ਨੂੰ ਕਹਿ ਦੇਈਏ ਪ੍ਰਚਾਰਿਤ ਕਰਨ ਵਾਸਤੇ ਜਿਵੇਂ ਕਾਰਡ ਬਣਾ ਦਿੰਦੇ ਹਨ ਕਾਰਡ ਦੇ ਸਹਾਰੇ ਕੀ ਹੁੰਦਾ ਹੈ ਕਿ ਜਿਵੇਂ ਕਿਸਾਨ ਨੇ ਬੀਜ ਖਰੀਦਣੇ ਹਨ ਬੀਜ ਖਰੀਦਣ ਲਈ ਉਹ ਕਾਰਡ ਦਿਖਾ ਕੇ ਬੀਜ ਖਰੀਦ ਸਕਦਾ ਉਹਦੇ ਨਾਲ ਕੀ ਹੁੰਦਾ ਕਿ ਉਹਦੇ 'ਤੇ ਕਿਸਾਨ ਦੀ ਕੋਈ ਵਿੱਤੀ ਕਹਿ ਦੇਈਏ ਭਾਰ ਨਹੀਂ ਪੈਂਦਾ ਉਹਦੇ ਕਾਰਡ ਦੇ ਸਹਾਰੇ ਉਹ ਆਪਣੀ ਜਿਹੜੀ ਕਹਿ ਦੇਈਏ ਵੀ ਬੀਜ ਖਰੀਦਣਾ ਵੇਚਣਾ ਇਹ ਸਭ ਕੰਮ ਆਸਾਨੀ ਨਾਲ ਕਰ ਸਕਦਾ ਉਹਦੇ ਨਾਲ ਉਹਦੀ ਬਹੁਤ ਵਿੱਤੀ ਸਹਾਇਤਾ ਹੁੰਦੀ ਹੈਗੀ ਹੈ